ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਨਿਧੀ ਹੈ ਔਰ ਅੱਜ ਅਸੀਂ ਟੈਕਨੋਲਜ਼ੀ ਬਾਰੇ ਗੱਲ ਕਰ ਰਹੇ ਹਾਂ ਟੈਕਨੋਲਜੀ ਦਾ ਸਾਡੀ ਰੋਜ਼ਾਨਾ ਜ਼ਿੰਦਗੀ 'ਚ ਬਹੁਤ ਹੀ ਵਧੀਆ ਪ੍ਰਭਾਵ ਪੈ ਰਿਹਾ ਹੈ ਜੇ ਅਸੀਂ ਪੜ੍ਹਾਈ ਕਰਦੇ ਹਾਂ ਤਾਂ ਜਦੋਂ ਅਸੀਂ ਕੋਲੇਜ ਅਤੇ ਸਕੂਲ ਵਿੱਚ ਸਾਨੂੰ ਕੋਈ ਕੰਮ ਮਿਲਦਾ ਹੈ ਪੜ੍ਹਾਈ 'ਤੇ ਰਿਲੇਟਡ ਤਾਂ ਅਸੀਂ ਗੂਗਲ 'ਤੇ ਸਰਚ ਕਰ ਸਕਦੇ ਹਾਂ ਹੈ ਨਾ ਹਰ ਚੀਜ਼ ਦਾ ਜਵਾਬ ਮਿਲ ਜਾਂਦਾ ਹੈ ਜਿਹੜੇ ਵੀ ਟੌਪਿਕ 'ਤੇ ਆਪਾਂ ਕੰਮ ਕਰਨਾ ਚਾਹੁੰਦੇ ਹਾਂ ਅਤੇ ਅਗਰ ਕੋਈ ਬੱਚਾ ਲੈਕਚਰ ਮਿਸ ਕਰ ਦਿੰਦਾ ਸਕੂਲ ਦੇ ਵਿੱਚ ਅਤੇ ਆਪਾਂ ਯੂਟਿਊਬ ਤੋਂ ਲੈਕਚਰ ਕੋਈ ਵੀ ਲੈਕਚਰ ਸਰਚ ਕਰੀਏ ਤਾਂ ਸਾਨੂੰ ਉਹ ਅਸਾਨੀ ਨਾਲ ਮਿਲ ਜਾਂਦਾ ਹੈ ਜਿਹਦੇ ਕਰਕੇ ਸਾਡੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਹੈਗੀ ਅਤੇ ਅਸੀਂ ਔਨਲਾਈਨ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਹਾਂ ਅਤੇ ਅਸੀਂ ਅੱਜ ਕੱਲ੍ਹ ਆਪਣੇ ਵਿਦੇਸ਼ਾਂ ਵਿੱਚ ਰਹਿੰਦੇ ਭੈਣ ਭਰਾਵਾਂ ਰਿਸ਼ਤੇਦਾਰਾਂ ਕਰੀਬੀਆਂ ਨਾਲ ਸੰਪਰਕ ਵਿੱਚ ਰਹਿ ਸਕਦੇ ਹਾਂ ਉਨ੍ਹਾਂ ਨੂੰ ਕੌਲਸ ਮੈਸੇਜਿਸ ਕਰਕੇ ਉਨ੍ਹਾਂ ਨੂੰ ਕਨੈਕਟਡ ਰਹਿ ਸਕਦੇ ਹਾਂ ਅਤੇ ਜੇ ਅਸੀਂ ਕਿਸੇ ਨਾਲ ਗੱਲ ਕਰਨਾ ਚਾਹੀਏ ਇੰਟਰਨੈੱਟ ਦੇ ਮਾਧਿਅਮ ਨਾਲ ਅਸੀਂ ਉਨ੍ਹਾਂ ਨਾਲ ਬਹੁਤ ਅਸਾਨੀ ਨਾਲ ਕਦੇ ਵੀ ਗੱਲ ਕਰ ਸਕਦੇ ਹਾਂ ਟੈਕਨੋਲਜੀ ਨੇ ਬਹੁਤ ਹੀ ਤਰੱਕੀ ਕੀਤੀ ਹੈ ਔਰ ਅਗਰ ਆਪਾਂ ਅੱਜ ਕੱਲ੍ਹ ਬੈਂਕ ਜਾਣ ਦੀ ਵਾਰ ਵਾਰ ਲੋੜ ਨਹੀਂ ਪੈਂਦੀ ਹੈਗੀ ਅਸੀਂ ਔਨਲਾਈਨ ਟ੍ਰਾਂਜੈਕਸ਼ਨਸ ਕਰ ਸਕਦੇ ਹਾਂ ਅਸੀਂ ਕਿਸੇ ਨਾਲ ਪੈਸੇ ਦਾ ਲੈਣ ਦੇਣ ਕਰ ਸਕਦੇ ਹਾਂ ਅਸੀਂ ਆਪਣੇ ਬੈਂਕ ਅਕਾਊਂਟ ਦੀ ਜਾਣਕਾਰੀ ਔਨਲਾਈਨ ਦੇਖ ਸਕਦੇ ਹਾਂ ਔਰ ਅਸੀਂ ਕਿਸੇ ਵੀ ਚੀਜ਼ ਦੀ ਇਨਵੈਂਸ਼ਨ ਕਰਨੀ ਹੋਏ ਤਾਂ ਅਸੀਂ ਔਨਲਾਈਨ ਉਹਦੇ ਬਾਰੇ ਰਿਸਰਚ ਕਰਕੇ ਨੋਲੇਜ ਲੈ ਸਕਦੇ ਹਾਂ ਅਸੀਂ ਨਵੀਆਂ ਨਵੀਆਂ ਚੀਜ਼ਾਂ ਬਣਾ ਸਕਦੇ ਹਾਂ ਨਵੀਆਂ ਨਵੀਆਂ ਚੀਜ਼ਾਂ 'ਤੇ ਅਸੀਂ ਐਕਸਪੀਰੀਐਂਸ ਲੈ ਸਕਦੇ ਹਾਂ ਅਸੀਂ ਕਿਤੇ ਜਾਣਾ ਹੋਏ ਤਾਂ ਅਸੀਂ ਪਹਿਲਾਂ ਉਹਦੇ ਬਾਰੇ ਔਨਲਾਈਨ ਸਰਚ ਕਰਕੇ ਦੇਖ ਸਕਦੇ ਹਾਂ ਕਿ ਉਹ ਜਗ੍ਹਾ ਕਿਵੇਂ ਦੀ ਹੈ ਸਾਨੂੰ ਉਸ 'ਤੇ ਜਾ ਕੇ ਅੱਛਾ ਲੱਗੇਗਾ ਜਾਂ ਨਹੀਂ ਲੱਗੇਗਾ ਸਾਨੂੰ ਉਸ ਚੀਜ਼ ਜਗ੍ਹਾ ਦੀ ਨੋਲੇਜ ਮਿਲ ਜਾਂਦੀ ਹੈ ਹਰ ਚੀਜ਼ ਦੀ ਨੋਲੇਜ ਸਾਨੂੰ ਮਿਲ ਜਾਂਦੀ ਹੈ